ਕੁਝ ਦਿਨ ਪਹਿਲਾਂ ਮੈਂ ਕਰੌਕਰੀ ਦਾ ਸਮਾਨ ਆਨਲਾਈਨ ਆਰਡਰ ਕੀਤਾ ਜੋ ਕਿ ਬਹੁਤ ਮਹਿੰਗਾ ਸੀ ਪਰ ਫਿਰ ਵੀ ਮੈਂ ਆਰਡਰ ਕੀਤਾ ਆਇਆ ਵੀ ਬਹੁਤ ਲੇਟ ਉਸ ਵਕਤ ਮੈਂ ਉਸ ਨੂੰ ਖੋਲ੍ਹ ਕੇ ਨਹੀਂ ਦੇਖਿਆ ਪਰ ਜਦੋਂ ਸਾਡੇ ਘਰ ਗੈਸਟ ਆਏ ਉਹਨਾਂ ਨੂੰ ਉਹਨਾਂ ਉਸ ਕਰੋਕਰੀ ਦੇ ਸਮਾਨ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਦੇਣ ਲਈ ਉਸ ਆਰਡਰ ਨੂੰ ਖੋਲ੍ਹਿਆ ਉਸ ਵਿੱਚ ਦੇਖਿਆ ਕਿ ਬਹੁਤ ਹੀ ਜ਼ਿਆਦਾ ਸ ਸਮਾਨ ਖਰਾਬ ਸੀ ਵਿੱਚ ਚਮਚੇ ਵੀ ਨਹੀਂ ਸਨ ਕੁਝ ਪਲੇਟਾਂ ਟੁੱਟੀਆਂ ਹੋਈਆਂ ਸਨ ਕੁਝ ਗਿਲਾਸ ਕਰੈਕ ਹੋਏ ਹੋਏ ਸਨ ਜਿਹਨਾਂ ਕਰਕੇ ਮੈਨੂੰ ਬਹੁਤ ਪਰੇਸ਼ਾਨੀ ਸਾਹਮਣੇ ਕਰਨੀ ਪਈ ਅਤੇ ਪਰਾਹੁਣਿਆਂ ਸਾਹਮਣੇ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਪਰਾਹੁਣਿਆਂ ਨੂੰ ਖਾਣਾ ਪਰੋਸਣ ਲਈ ਮੈਨੂੰ ਆਸ ਪਾਸ ਤੋਂ ਬਰਤਨ ਇਕੱਠੇ ਕਰਨੇ ਪਏ ਜਿਹਨਾਂ ਕਰਕੇ ਮੈਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਆਨਲਾਈਨ ਆਰਡਰ ਕੀਤੀ ਹੋਈ ਕਰੋਕਰੀ ਕਾਰਨ ਮੈਨੂੰ ਕਾਫੀ ਸ਼ਰਮਿੰਦਗੀ ਮਹਿਸੂਸ ਕਰਨੀ ਪਈ